ਮੇਰੇ ਕੋਲ ਇਹੋ ਜਿਹੀਆਂ ਬਹੁਤ ਸਾਰੀਆਂ ਕਿਤਾਬਾਂ ਹਨ ਜੋ ਮੈਂ ਕਈ ਵਾਰ ਪੜ੍ਹਨਾ ਪਸੰਦ ਕਰਦਾ ਹਾਂ ਇਹਨਾਂ ਦੇ ਵਿੱਚੋਂ ਜਿਵੇਂ ਕਿ ਇੱਕ ਕਿਤਾਬ ਮਹਾਰਾਜਾ ਰਣਜੀਤ ਸਿੰਘ 'ਤੇ ਲਿਖੀ ਹੋਈ ਹੈ ਜੋ ਕਿ ਮੈਂ ਲਗਭਗ ਤਿੰਨ ਵਾਰ ਪੜ੍ਹ ਚੁੱਕਿਆ ਹਾਂ ਅਤੇ ਇੱਕ ਕਿਤਾਬ ਬਾਬਾ ਬੰਦਾ ਸਿੰਘ ਬਹਾਦਰ ਜੀ 'ਤੇ ਹੈ ਜੋ ਕਿ ਮੈਂ ਦੋ ਵਾਰ ਪੜ੍ਹ ਚੁੱਕਿਆ ਹਾਂ ਇਹ ਕਿਤਾਬ ਮੈਂ ਬਾਰ ਬਾਰ ਇਸ ਲਈ ਪੜ੍ਹਦਾ ਹਾਂ ਕਿਉਂਕਿ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਮੈਂ ਆਪ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੁੰਦਾ ਹਾਂ ਬਾਰ ਬਾਰ ਪੜ੍ਹ ਕੇ ਮੈਂ ਉਹਨਾਂ ਦੇ ਦੁਆਰਾ ਕੀਤੇ ਗਏ ਚੰਗੇ ਕੰਮਾਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਚਾਹੁੰਦਾ ਹਾਂ ਸੋ ਸੱਚ ਹੀ ਮੈਂ ਇਹ ਦੋਨੇ ਕਿਤਾਬਾਂ ਦੇ ਉੱਤੇ ਇੱਕ ਫਿਲਮ ਦੇਖਣਾ ਜ਼ਰੂਰ ਪਸੰਦ ਕਰਦਾ ਹਾਂ ਜੋ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ 'ਤੇ ਬਣੀ ਹੋਵੇ ਅਤੇ ਉਹਨਾਂ ਦੇ ਦੁਆਰਾ ਕੀਤੇ ਗਏ ਚੰਗੇ ਕੰਮਾਂ ਨੂੰ ਉਸ ਫਿਲਮ ਦੇ ਵਿੱਚ ਦਿਖਾਇਆ ਜਾਵੇ